ਜੋ ਕਿ ਅੱਜ ਕੱਲ੍ਹ ਦੀ ਜਿਹੜੀ ਸਮੱਸਿਆ ਚੱਲ ਰਹੀ ਹੈ ਕਿ ਜੋ ਪਹਿਲਾਂ ਜ਼ਿੰਦਗੀ ਵਿੱਚ ਜਿਹੜੀਆਂ ਉਹ ਡਾਇਟਾਂ ਮਿਲਦੀਆਂ ਸੀ ਜੋ ਕਿ ਪਿਛਲੇ ਜਮਾਨਿਆਂ ਵਿੱਚ ਕਿ ਹਰ ਇੱਕ ਚੀਜ਼ ਘਰ ਬਣਾਉਣੀ ਹਰ ਇੱਕ ਚੀਜ਼ ਬੱਚਿਆਂ ਨੇ ਰਲ ਮਿਲ ਕੇ ਖਾਣੀ ਬਟ ਉਹ ਚੀਜ਼ਾਂ ਅੱਜ ਕੱਲ੍ਹ ਕਿਤੇ ਨਾ ਕਿਤੇ ਮਤਲਬ ਲਾਪਰਵਾਹ ਲਾਪਰਵਾਹੀ ਹੋ ਰਹੀ ਉਹ ਚੀਜ਼ ਵਿੱਚ ਜੋ ਪਹਿਲਾਂ ਚੀਜ਼ਾਂ ਸੀ ਉਹ ਚੀਜ਼ਾਂ ਹੁਣ ਇਸ ਟਾਈਮ 'ਤੇ ਨਹੀਂ ਹੈਗੀਆਂ ਹੁਣ ਅੱਜ ਕੱਲ੍ਹ ਜਿਹੜੇ ਬੱਚੇ ਵੀ ਨੇ ਉਹ ਵੀ ਘਰ ਦੀ ਚੀਜ਼ ਛੱਡ ਕੇ ਬਾਹਰ ਜੰਕ ਫੂਡ ਵਗੈਰਾ ਖਾਂਦੇ ਨੇ ਕਿ ਜਿਹਦੇ ਨਾਲ ਉਹਨਾਂ ਨੂੰ ਨਿਊਟਰੀਸ਼ਨ ਜਿਹੜਾ ਬਿਲਕੁਲ ਵੀ ਨਹੀਂ ਮਿਲ ਰਿਹਾ ਤੇ ਅੱਜ ਕੱਲ੍ਹ ਜਿਹੜਾ ਅ ਸਾਫ ਪਾਣੀ ਹੈ ਸਾਫ ਪਾਣੀ ਜਿਹੜਾ ਹੈ ਕੁਝ ਥਾਵਾਂ 'ਤੇ ਸਾਫ ਪਾਣੀ ਆ ਰਿਹਾ ਬਟ ਕਈਆਂ ਅੱਜ ਕੱਲ੍ਹ ਤਾਂ ਆਮ ਤੌਰ 'ਤੇ ਸਭ ਨੇ ਆਪਣੇ ਘਰਾਂ ਵਿੱਚੋਂ ਫਿਲਟਰ ਲ ਫਿਲਟਰ ਪਾਣੀ ਲਗਵਾ ਲਿਆ ਹੋਇਆ ਜਿਹਦੇ ਕਰਕੇ ਸਾਫ ਪਾਣੀ ਸਭ ਨੂੰ ਮਿਲ ਰਿਹਾ ਹੈ ਕਿ ਸਮੱਸਿਆ ਬਸ ਇਹ ਹੀ ਹੈ ਕਿ ਜਿਹੜਾ ਜਿਹੜਾ ਭੋਜਨ ਹੈ ਉਹ ਭੋਜਨ ਜਿਹੜਾ ਅੱਜ ਕੱਲ੍ਹ ਲੋਕ ਘਰ ਖਾਂਦੇ ਸੀ ਉਹ ਹੁਣ ਬਿਲਕੁਲ ਨਹੀਂ ਖਾਂਦੇ ਘਰ ਜਿਹੜਾ ਬਣਿਆ ਬਣਿਆ ਹੋਇਆ ਉਹ ਹੁਣ ਬਿਲਕੁਲ ਨਹੀਂ ਖਾਂਦੇ ਜਿਹੜਾ ਬਾਹਰ ਦੀਆਂ ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਆਮ ਤੌਰ 'ਤੇ ਥਾਂ ਥਾਂ 'ਤੇ ਰੇਹੜੀਆਂ ਲੱਗੀਆਂ ਹੋਈਆਂ ਨੇ ਜਿਹਦੇ ਕਰਕੇ ਗੰਦਾ ਨਾਲੀ ਦੇ ਕੋਲ ਜਿਹੜੀਆਂ ਰੇਹੜੀਆਂ ਲੱਗੀਆਂ ਹੁੰਦੀਆਂ ਨੇ ਉਹਦੇ ਸਾਫ ਪਾਣੀ ਬਿਲਕੁਲ ਨਹੀਂ ਉੱਥੇ ਮਿਲਦਾ ਬੱਚੇ ਉਹ ਚੀਜ਼ਾਂ ਮਤਲਬ ਬਾਹਰ ਦਾ ਜੰਕ ਫੂਡ ਖਾ ਖਾ ਕੇ ਬਿਮਾਰ ਹੋ ਜਾਂਦੇ ਨੇ ਜੋ ਮਤਲਬ ਪਹਿਲਾਂ ਜ਼ਿੰਦਗੀ ਵਿੱਚ ਚੀਜ਼ਾਂ ਸੀ ਉਹ ਚੀਜ਼ਾਂ ਹੁਣ ਕਿਤੇ ਨਾ ਕਿਤੇ ਮਤਲਬ ਮਿਸ ਹੋ ਰਹੀਆਂ ਨੇ ਉਹ ਚੀਜ਼ਾਂ ਨਹੀਂ ਮਿਲ ਰਹੀਆਂ ਜ਼ਿਆਦਾਤਰ ਲੋਕ ਬਾਹਰ ਦਾ ਹੀ ਖਾਣਾ ਪਸੰਦ ਕਰਦੇ ਨੇ ਜਿਹਦੇ ਕਰਕੇ ਉਹਨਾਂ ਨੂੰ ਅੱਸੀ ਪ੍ਰਸੈਂਟ ਨੱਬੇ ਪ੍ਰਸੈਂਟ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਕਰਕੇ ਅੱਜ ਕੱਲ੍ਹ ਦਾ ਨਿਊਟਰੀਸ਼ਨ ਕਿਤੇ ਨਾ ਕਿਤੇ ਗਾਇਬ ਹੋ ਰਿਹਾ ਹੈ ਜੋ ਕਿ ਨਹੀਂ ਮਿਲ ਰਿਹਾ ਕਿਸੇ ਨੂੰ ਕਿਉਂਕਿ ਬਾਹਰ ਦਾ ਇੰਨਾ ਜੰਕ ਫੂਡ ਮਤਲਬ ਚੱਲ ਰਿਹਾ ਕਿ ਬੱਚਿਆਂ ਜ਼ਿਆਦਾ ਤੋਂ ਜ਼ਿਆਦਾ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ